ਮੈਂ ਸਿਲਾਈ ਦਾ ਕੰਮ ਕਰਦੀ ਹਾਂ ਵੈਸੇ ਤਾਂ ਆਪਾਂ ਬਹੁਤ ਧਿਆਨ ਨਾਲ ਕੰਮ ਕਰਦੇ ਹਾਂ ਪਰ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਹੈ ਇੱਕ ਵਾਰੀ ਮੈਂ ਕਿਸੇ ਦਾ ਏ ਸ਼ੇਪ ਦਾ ਸੂਟ ਸਿਊਣ ਲੱਗੀ ਸੀਗੀ ਅਤੇ ਉਹ ਥੋੜ੍ਹਾ ਮੇਰੇ ਤੋਂ ਖਰਾਬ ਹੋ ਗਿਆ ਫਿਰ ਮੈਂ ਦਿਮਾਗ ਲਗਾਇਆ ਵੀ ਇਹਨੂੰ ਹੁਣ ਮੈਂ ਠੀਕ ਕਿਵੇਂ ਕਰਾਂ ਇਹਨੂੰ ਕਰਨਾ ਤਾਂ ਏ ਸ਼ੇਪ ਦਾ ਹੀ ਹੈਗਾ ਕੀ ਅਗਲੇ ਨੂੰ ਐਵੇਂ ਵੀ ਨਾ ਲੱਗੇ ਕਿ ਮੇਰਾ ਖਰਾਬ ਹੋ ਗਿਆ ਅਤੇ ਫਿਰ ਮੈਂ ਦਿਮਾਗ ਲਗਾਇਆ ਅਤੇ ਫਿਰ ਉਹਨੂੰ ਮੈਂ ਕਲੀਆਂ ਵਾਲਾ ਬਣਾ ਤਾ ਸੂਟ ਕਲੀਆਂ ਕੱਟ ਕੱਟ ਕੇ ਲਗਾ ਤੀਆਂ ਹੈਗੀਆਂ ਜਿਹਦੇ ਨਾਲ ਉਹ ਖਰਾਬ ਵੀ ਨਹੀਂ ਹੋਇਆ ਉਹ ਏ ਲਾਈਨ ਦਾ ਵੀ ਬਣ ਗਿਆ ਅਤੇ ਕਲੀਆਂ ਨਾਲ ਉਹਦਾ ਡਿਜ਼ਾਇਨ ਵੀ ਬਣ ਗਿਆ ਉਹ ਡਿਜ਼ਾਇਨਰ ਸੂਟ ਬਣ ਗਿਆ ਅਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਇੱਕ ਵਾਰੀ ਐਵੇਂ ਹੀ ਮੇਰੇ ਕੋਲੋਂ ਕਿਸੇ ਦਾ ਗਲਾ ਥੋੜ੍ਹਾ ਹੋ ਗਿਆ ਵੀ ਖਰਾਬ ਸ਼ੇਪ ਉਹਦੀ ਗਲੇ ਦੀ ਖਰਾਬ ਹੋ ਗਈ ਪਰ ਉਹ ਗਲਾ ਥੋੜ੍ਹਾ ਮੈਂ ਛੋਟਾ ਬਣਾਇਆ ਸੀ ਇਸ ਵਾਸਤੇ ਫਿਰ ਮੈਂ ਉਹਨਾਂ ਦਾ ਸੁਧਾਰ ਕੀਤਾ ਮੈਂ ਥੋੜ੍ਹਾ ਜਿਹਾ ਉਹਨੂੰ ਵੱਡਾ ਕਰਤਾ ਦੁਬਾਰਾ ਬਣਾਇਆ ਗਲਾ ਅਤੇ ਫਿਰ ਉਹ ਸਹੀ ਬਣ ਗਿਆ ਉਹਦੇ ਨਾਲ ਗਲਾ ਜਦੋਂ ਮੈਂ ਪਲਾਜੋ ਸਿਊਣ ਲੱਗੀ ਤਾਂ ਪਲਾਜੋ ਪਹਿਲਾਂ ਪਹਿਲਾਂ ਸਾਰਿਆਂ ਨੂੰ ਸੈੱਟ ਨਹੀਂ ਆਉਂਦੇ ਸੀਗੇ ਫਿਰ ਮੈਂ ਬੜੀ ਉਹਦੀ ਕੋਸ਼ਿਸ਼ ਕੀਤੀ ਅਤੇ ਕਿਸੇ ਤੋਂ ਫਿਰ ਮੈਂ ਸਿੱਖਿਆ ਹੈਗਾ ਕਿਸੇ ਟੇਲਰ ਤੋਂ ਸੀ ਦਰਜੀ ਤੋਂ ਸਿੱਖਿਆ ਮੈਂ ਹੁਣ ਮੈਂ ਉ ਉਸੇ ਹਿਸਾਬ ਨਾਲ ਕਟਾਈ ਕਰਦੀ ਹੈਗੀ ਹਾਂ ਅਤੇ ਉਸ ਹਿਸਾਬ ਨਾਲ ਸੀਂਦੀ ਹਾਂ ਤਾਂ ਕਿ ਉਹ ਸਾਰਿਆਂ ਨੂੰ ਹੁਣ ਹੁਣ ਸਹੀ ਆਉਂਦੇ ਆ ਨਾ ਉਹ ਉੱਚੇ ਚਕੀਨ ਅਤੇ ਬਿਲਕੁਲ ਇਹ ਫਿੱਟ ਐਂਡ ਫਾਈਨ ਆਉਂਦੇ ਹੈਗੇ ਆ